ਮੇਰੇ ਮਨਪਸੰਦ ਪੌਦੇ ਜਿਵੇਂ ਗੁਲਾਬ ਦਾ ਪੌਦਾ ਗੈਂਦੇ ਦਾ ਪੌਦਾ ਗੁਲਦਉਤੀ ਦਾ ਪੌਦਾ ਅਤੇ ਸੂਰਜਮੁਖੀ ਦਾ ਪੌਦਾ ਮੇਰੇ ਕੋਲ ਪੰਜ ਕਿੱਲੇ ਜ਼ਮੀਨ ਹੈ ਜਿਹਦੇ ਵਿੱਚ ਮੈਂ ਸਾਰੀ ਜ਼ਮੀਨ ਵਿੱਚ ਗੁਲਾਬ ਗੈਂਦਾ ਲੀਲੀ ਸੂਰਜਮੁਖੀ ਦੀ ਖੇਤੀ ਕੀਤੀ ਹੋਈ ਹੈ ਅਤੇ ਇਹਨਾਂ ਫ ਫੁੱਲਾਂ ਦੀ ਮੈਂ ਆਪ ਕੇਅਰ ਕਰਦਾ ਹਾਂ ਇਹਨਾਂ ਨੂੰ ਸਮੇਂ ਸਿਰ ਪਾਣੀ ਅਤੇ ਸਮੇਂ ਸਿਰ ਇਹਨਾਂ ਨੂੰ ਖਾਦ ਪਾਉਂਦਾ ਹਾਂ ਮੇਰੇ ਜ ਜਿੰਨੇ ਫੁੱਲ ਲੱਗੇ ਹਨ ਇਹ ਫੁੱਲ ਆਊਟ ਓਫ਼ ਸਟੇਸ਼ਨ ਮੇਰੇ ਸ਼ਹਿਰ ਤੋਂ ਬਾਹਰ ਵੀ ਜਾਂਦੇ ਹਨ ਅਤੇ ਮੇਰੇ ਕੋਲੋਂ ਸ਼ਹਿਰ ਦੇ ਫਿਰ ਫੁੱਲਾਂ ਵਾਲੇ ਵਪਾਰੀ ਆਉਂਦੇ ਹਨ ਅਤੇ ਮੇਰੇ ਤੋਂ ਜ਼ਿਆਦਾ ਮਾਤਰਾ ਵਿੱਚ ਉਹ ਫੁੱਲਾਂ ਨੂੰ ਲੈ ਜਾਂਦੇ ਹਨ ਅਤੇ ਉਹ ਫਿਰ ਮਾਰਕੀਟ ਵਿੱਚ ਉਹਨਾਂ ਫੁੱਲਾ ਨੂੰ ਸੇਲ ਕਰ ਦਿੰਦੇ ਹਨ ਇਹਨਾਂ ਫੁੱਲਾਂ ਦੀ ਵਰਤੋਂ ਡੈਕੋਰੇਸ਼ਨ ਵਿੱਚ ਕੀਤੀ ਜਾਂਦੀ ਹੈ ਜਿਵੇਂ ਕਿ ਵਿਆਹ ਸਮੇਂ ਡੋਲੀ ਵਾਲੀ ਕਾਰ ਲਈ ਕੀਤੀ ਜਾਂਦੀ ਆ ਅਤੇ ਮੰਦਰਾਂ ਵਿੱਚ ਕੀਤੀ ਜਾਂਦੀ ਹੈ ਅਤੇ ਗੁਰਦੁਆਰਿਆਂ ਵਿੱਚ ਕੀਤੀ ਜਾਂਦੀ ਹੈ ਇਹਨਾਂ ਫੁੱਲਾਂ ਨੂੰ ਹੋਰ ਵੀ ਖੁਸ਼ੀ ਦੇ ਪ੍ਰੋਗਰਾਮਾਂ ਵਿੱਚ ਵਰਤੋਂ ਵਿੱਚ ਲਿਆਉਂਦਾ ਜਾਂਦਾ ਹੈ ਅਤੇ